ਹਾਂ ਇੱਕ ਦਿਨ ਲਈ ਇੱਕ ਮਸ਼ਹੂਰ ਤਕਨੀਕੀ ਉੱਦਮੀ ਦੇ ਨਾਲ਼ ਜੀਵਨ ਬਦਲਿਆ ਜਾ ਸਕਦਾ ਹੈ ਪਰ ਇੱਕ ਚੰਗਾ ਤਕਨੀਕੀ ਉੱਦਮੀ ਹੋਵੇ ਤਾਂ ਬਹੁਤ ਕੁਛ ਬਦਲਿਆ ਵੀ ਜਾ ਸਕਦਾ ਹੈ ਪਰ ਮੈਂ ਇ ਇਸ ਟਾਈਮ ਇਸ ਸਮੇਂ ਵਿੱਚ ਇੱਕ ਰਾਤਾ ਟਟਨ ਰ ਰਤਨ ਟਾਟਾ ਵਾਲੇ ਨੂੰ ਮਿਲਣਾ ਚਾਹਵਾਂਗੀ ਪਰ ਉਹ ਇਸ ਦੁਨੀਆਂ ਵਿੱਚ ਹੁਣ ਨਹੀਂ ਹਨ ਮੈਂ ਉਹਨਾਂ ਤੋਂ ਇਹ ਸਿੱਖਣਾ ਚਾਂਦੀ ਸੀ ਕਿ ਉਨ੍ਹਾਂ ਨੇ ਆਪਣਾ ਕਿਵੇਂ ਇੱਕ ਤਕਨੀਕੀ ਦੌਰ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਅਤੇ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਸੰਘਰਸ਼ ਕੀ ਕਰਦਿਆਂ ਹੋਇਆ ਵੀ ਆਪਣੇ ਜੀਵਨ ਨੂੰ ਬਹੁਤ ਉਪਰ ਤੱਕਰ ਲੈ ਕੇ ਗਏ ਅਤੇ ਮੈਂ ਉਹਨਾਂ ਤੋਂ ਸਿੱਖਦੀ ਕਿ ਉਨ੍ਹਾਂ ਨੇ ਮੋਟਰ ਕਾਰਾਂ ਅਤੇ ਤਕਨੀਕਾਂ ਵਿੱਚ ਕੀ ਕੀ ਬਦਲਾਅ ਲੈ ਕੇ ਆਏ ਤਾਂ ਜੋ ਆਪਣੇ ਜੀਵਨ ਨੂੰ ਬਹੁਤ ਤਰੱਕੀ ਵੱਲ ਲੈ ਕੇ ਗਏ ਅਤੇ ਇਹ ਸਭ ਤੋਂ ਜ਼ਿਆਦਾ ਵਧੀਆ ਹੁੰਦਾ ਜੇਕਰ ਮੈਂ ਉਹਨਾਂ ਨੂੰ ਆਪਣੇ ਸਮੇਂ ਵਿੱਚ ਮਿਲ ਸਕਦੀ ਰਤਨ ਟਾਟਾ ਇੱਕ ਬਹੁਤ ਹੀ ਮਿਹਨਤੀ ਇਨਸਾਨ ਸੀ ਅਤੇ ਬਹੁਤ ਵਧੀਆ ਇਨਸਾਨ ਸੀ ਜਿਨ੍ਹਾਂ ਨੇ ਕੀ ਆਪਣੇ ਤਕਨੀਕੀ ਉੱਦਮ ਵਿੱਚ ਬਹੁਤ ਤਰੱਕੀ ਕੀਤੀ ਸਭ ਤੋਂ ਘੱਟ ਸਮੇਂ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਨੂੰ ਬਹੁਤ ਬਦਲਿਆ ਅਤੇ ਉਹ ਦੂਜਿਆਂ ਨੂੰ ਵੀ ਬਦਲਣ ਦੀ ਸਿੱਖਿਆ ਦਿੰਦੇ ਸਨ ਉਹ ਆਪਣੇ ਆਪ 'ਤੇ ਇਹ ਇੱਕ ਮਾਣ ਮਹਿਸੂਸ ਕਰਦੇ ਸਨ ਕਿ ਜੇਕਰ ਉਹ ਕਿਸੇ ਨੂੰ ਕੁਛ ਦੱਸਦੇ ਪਰ ਅੱਜ ਦੇ ਸਮੇਂ ਵਿੱਚ ਕੋਈ ਵੀ ਬੰਦਾ ਜੇ ਤਕਨੀਕੀ ਵਿੱਚ ਸਿੱਖ ਵੀ ਜਾਂਦਾ ਹੈ ਉਹ ਕਿਸੇ ਦੂਸਰੇ ਨੂੰ ਦੱਸਣ ਤੋਂ ਗੁਰੇਜ਼ ਕਰਦਾ ਹੈ ਪਰ ਰਤਨ ਟਾਟਾ ਵਰਗੇ ਜਿਹੇ ਇਨਸਾਨ ਇਹੋ ਜਿਹੀ ਗੁਰੇਜ਼ ਨਹੀਂ ਕਰਦੇ ਸਨ ਉਹ ਇਹ ਨਹੀਂ ਸੋਚਦੇ ਸਨ ਕੀ ਹਾਂ ਵਈ ਜੇਕਰ ਉਨ੍ਹਾਂ ਨੂੰ ਕੁਝ ਆਇਆ ਹੈ ਤਾਂ ਇਨ੍ਹਾਂ ਵਿੱਚ ਵੀ ਕੋਈ ਕਿਸੇ ਹੋਰ ਨੂੰ ਵੀ ਆਣਾ ਚਾਹੀਦਾ ਹੈ ਤਾਂ ਜੋ ਜਿਵੇਂ ਮੈਂ ਤਰੱਕੀ ਕੀਤੀ ਹੈ ਅਤੇ ਦੂਸਰਾ ਇਨਸਾਨ ਵੀ ਉਨੀ ਹੀ ਮੇਰੇ ਵਾਂਗ ਤਰੱਕੀ ਕਰੇ ਓ ਇਸ ਗੱਲ ਦਾ ਬਹੁਤ ਮਾਣ ਕਰਦੇ ਸਨ